ਸਾਡੇ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਵਹਿਮ ਭਰਮ ਹਨ ਜਿਹਨਾਂ 'ਤੇ ਲੋਕ ਅੱਖਾਂ ਮੀਟ ਕੇ ਵਿਸ਼ਵਾਸ ਕਰਦੇ ਹਨ ਫ਼ ਉਦਾਹਰਨ ਦੇ ਤੌਰ 'ਤੇ ਕਾਲੀ ਬਿੱਲੀ ਦਾ ਰਾਸਤਾ ਕੱਟਣਾ ਕੁਝ ਇਸ ਇੱਦਾਂ ਦਾ ਮੰਨਿਆ ਜਾਂਦਾ ਹੈ ਕਿ ਜਦੋਂ ਅਸੀਂ ਕੋਈ ਸ਼ੁਭ ਕੰਮ ਲਈ ਜਾਂਦੇ ਹਨ ਤਾਂ ਰਸਤੇ ਵਿੱਚ ਜਦੋਂ ਕਾਲੀ ਬਿੱਲੀ ਰਸਤਾ ਕੱਟ ਜਾਂਦੀ ਹੈ ਤਾਂ ਇਸਨੂੰ ਅਪਸ਼ਗਨ ਮੰਨਿਆ ਜਾਂਦਾ ਆ ਅਤੇ ਇਸ ਤੋਂ ਇਲਾਵਾ ਛਿੱਕ ਮਾਰਨਾ ਵੀ ਇੱਕ ਵਹਿਮ ਭਰਮ ਹੀ ਹੈ ਜਦੋਂ ਅਸੀਂ ਕਿਸੇ ਚੰਗੇ ਕੰਮ ਦੇ ਲਈ ਜਾਂਦੇ ਆ ਤਾਂ ਕੋਈ ਬੰਦਾ ਅੱਗੋਂ ਛਿੱਕ ਮਾਰ ਦਿੰਦਾ ਹੈ ਤਾਂ ਉਸਨੂੰ ਵੀ ਇਹ ਕਿਹਾ ਜਾਂਦਾ ਆ ਵੀ ਇਹ ਵੀ ਸਾਡਾ ਕੰਮ ਨਹੀਂ ਬਣਨਾ ਅਤੇ ਇਸ ਤੋਂ ਇਲਾਵਾ ਸ਼ੁ ਜਿ ਜਿੱਦਾਂ ਕਿ ਕੁਝ ਦਿਨਾਂ 'ਤੇ ਵੀ ਵਿਚਾਰ ਕੀਤੀ ਜਾਂਦੀ ਆ ਸ਼ੁੱਕਰਵਾਰ ਨੂੰ ਵਾਲ ਨਹੀਂ ਕਟਵਾਉਣੇ ਮੰਨਿਆ ਜਾਂਦਾ ਹੈ ਕਿ ਸ਼ੁੱਕਰਵਾਰ ਨੂੰ ਬਾਹਰ ਵਾਲ ਕਟਵਾਉਣ ਦੇ ਨਾਲ ਘਰ ਦੇ ਵਿੱਚ ਬਿਮਾਰੀ ਆ ਜਾਂਦੀ ਆ ਅਤੇ ਇਸ ਤੋਂ ਇਲਾਵਾ ਨਿੰਬੂ ਮਿਰਚਾਂ ਟੰਗਣਾ ਦੁਕਾਨਾਂ ਅਤੇ ਘਰਾਂ ਦੇ ਬਾਹਰ ਕੁਝ ਲੋਕ ਨਿੰਬੂ ਮਿਰਚਾਂ ਟੰਗਦੇ ਹਨ ਅਤੇ ਇਸ ਤੋਂ ਇਹ ਪਤਾ ਇਸ ਤੋਂ ਉਹ ਇਹ ਸ ਇਹ ਸਮਝਦੇ ਹਨ ਕਿ ਇਹ ਜਾਦੂ ਜਾਦੂ ਟੂਣੇ ਬੁਰੀ ਨਜ਼ਰ ਤੋਂ ਬਚਾਉਂਦੇ ਹਨ ਅਤੇ ਹੋਰ ਵੀ ਬਹੁਤ ਸਾਰੇ ਜਿੱਦਾਂ ਵਹਿਮ ਭਰਮ ਹਨ ਜਿਵੇਂ ਕਿ ਘਰ ਤੋਂ ਬਾਹਰ ਸਮੇਂ ਕੋਈ ਪਿੱਛੋਂ ਟੋਕ ਦਿੰਦਾ ਆ ਜਾਂ ਕੋਈ ਘਰ ਤੋਂ ਬਾਹਰ ਜਾ ਰਿਹਾ ਹੋਵੇ ਤਾਂ ਉਸਨੂੰ ਕੋਈ ਪਿੱਛੋਂ ਟੋਕ ਦੇਵੇ ਤਾਂ ਮੰਨਿਆ ਜਾਂਦਾ ਹੈ ਕਿ ਉਸ ਦਾ ਜਿਹੜਾ ਕੰਮ ਆ ਉਹ ਖ਼ਰਾਬ ਹੋ ਜਾਂਦਾ ਆ ਅਤੇ ਧੰਨਵਾਦ